ਨਮਸਕਾਰ ਮੇਰਾ ਨਾਮ ਸਾਕਸ਼ੀ ਹੈ ਅਤੇ ਮੈਂ ਪਠਾਨਕੋਟ ਦੇ ਰਹਿਣ ਵਾਲੀ ਹਾਂ ਸਾਡੇ ਇੱਥੇ ਮਾਤਾ ਦਾ ਬਹੁਤ ਜ਼ਿਆਦਾ ਗੁਣਗਾਨ ਕੀਤਾ ਜਾਂਦਾ ਹੈ ਸਾਡੇ ਪੰਜਾਬ ਵਿੱਚ ਲੋਕ ਮਾਤਾ ਦੀ ਬਹੁਤ ਪੂਜਾ ਅਰਚਨਾ ਕਰਦੇ ਹਨ ਇਹ ਹੀ ਸਾਡੇ ਇੱਥੋਂ ਦੇ ਰੀਤੀ ਰਿਵਾਜ਼ ਹਨ ਅਤੇ ਧਰਮ ਧਾਰਮਿਕ ਪਰੰਪਰਾਵਾਂ ਦੀ ਪਾਲਣਾ ਹੈ ਲੋਕ ਮਾਤਾ ਦੇ ਨਰਾਤੇ ਮਨਾਉਂਦੇ ਹਨ ਜਿਸ ਵਿੱਚ ਲੋਕ ਆਪਣੇ ਘਰ ਵਿੱਚ ਨੌਂ ਦਿਨ ਮਾਤਾ ਲਗਾਉਂਦੇ ਹਨ ਅਤੇ ਉਹਨਾਂ ਦੀ ਰੱਜ ਕੇ ਸੇਵਾ ਕਰਦੇ ਹਨ ਇਸ ਤਰ੍ਹਾਂ ਇਹ ਨਰਾਤੇ ਸਾਲ ਵਿੱਚ ਦੋ ਵਾਰ ਆਉਂਦੇ ਹਨ ਇਸ ਤਰ੍ਹਾਂ ਹੀ ਲੋਕ ਆਪਣੇ ਇੱਥੇ ਹਰ ਮੰਗਲਵਾਰ ਨੂੰ ਮਾਤਾ ਦੇ ਜਾਂਦੇ ਹਨ ਅਤੇ ਮਾਤਾ ਦੀ ਪੂਜਾ ਅਰਚਨਾ ਕਰਦੇ ਹਨ ਅਸੀਂ ਵੀ ਆਪਣੇ ਲੋਕ ਇਲਾਕੇ ਬਾਹਰ ਵਾਲੀ ਮਾਤਾ ਦੇ ਮੰਦਿਰ 'ਤੇ ਜਾਂਦੇ ਹਾਂ ਅਤੇ ਮਾਤਾ ਦੀ ਪੂਜਾ ਅਰਚਨਾ ਕਰਦੇ ਹਨ ਲੋਕ ਉੱਥੇ ਜਾ ਕੇ ਆਪਣੀ ਮਨੋਕਾਮਾ ਨ ਕਾਮਨਾਵਾਂ ਮੰਗਦੇ ਹਨ ਅਤੇ ਭਗਵਾਨ ਦੀ ਪੂਜਾ ਅਰਚਨਾ ਕਰਦੇ ਹਨ ਸਾਡੇ ਪੰਜਾਬ ਦੇ ਲੋਕ ਮਾਤਾ ਦੇ ਵਿੱਚ ਕਾਫ਼ੀ ਵਿਸ਼ਵਾਸ ਰੱਖਦੇ ਹਨ ਅਤੇ ਉਹ ਸਾਲ ਵਿੱਚ ਵੈਸ਼ਨੋ ਮਾਤਾ ਦੇ ਵੀ ਜ਼ਰੂਰ ਜਾਂਦੇ ਹਨ ਅਸੀਂ ਵੀ ਇਹਨਾਂ ਰੀਤੀ ਰਿਵਾਜ਼ਾਂ ਦਾ ਕਾਫ਼ੀ ਜ਼ਿਆਦਾ ਪਾਲਣਾ ਕਰਦੇ ਹਾਂ ਅਤੇ ਇਹਨਾਂ ਦਾ ਮਾਨ ਸਨਮਾਨ ਕਰਦੇ ਹਾਂ ਧੰਨਵਾਦ